ਹੈਲੋ ਹੈਲੋ ਹੈਲੋ ਹਾਂਜੀ ਕਾਰ ਮਕੈਨਿਕ ਬੋਲੋ ਰਹੇ ਹੋ ਹਾਂਜੀ ਐਕਚੁਲੀ ਨਾ ਸਾਡੀ ਕਾਰ ਵਿੱਚ ਪ੍ਰੋਬਲਮ ਆ ਗਈ ਹੈ ਅਤੇ ਉਹਦੀ ਇੱਕ ਏ ਸੀ ਦੀ ਪ੍ਰੋਬਲਮ ਆ ਰਹੀ ਹੈ ਅਤੇ ਇੱਕ ਗੇਅਰ ਵਿੱਚ ਦਿੱਕਤ ਆ ਰਹੀ ਹੈ ਅਤੇ ਦੱਸੋ ਉਹਨੂੰ ਠੀਕ ਕਰ ਲਿਆ ਦਰਅਸਲ ਕੋਈ ਛੱਡ ਕੇ ਨਹੀਂ ਜਾ ਸਕਦੇ ਤੁਹਾਨੂੰ ਖੁਦ ਹੀ ਕੋਈ ਭੇਜਣਾ ਪਏਗਾ ਲਿਜਾਉਣ ਵਾਸਤੇ ਹਾਂਜੀ ਹਾਂਜੀ ਹਾਂਜੀ ਸਾਨੂੰ ਅੱਜ ਹੀ ਚਾਹੀਦੀ ਹੈ ਐਕਚੁਲੀ ਅਸੀਂ ਬਾਹਰ ਜਾਣਾ ਕੱਲ੍ਹ ਅਤੇ ਪਰੇ ਸਾਡਾ ਘਰ ਆਦਰਸ਼ ਨਗਰ ਵਿੱਚ ਲੋਕੇਸ਼ਨ ਸੈਂਡ ਕਰ ਦਾਂਗੇ ਤੁਸੀਂ ਆਪਣੇ ਘਰ ਦੀ ਪਹੁੰਚਾ ਦੇਣਾ ਜਲਦੀ ਤੋਂ ਜਲਦੀ ਚਾਹੀਦੀ ਹੈ ਸਾਨੂੰ ਪੂਰੀ ਅੱਛੀ ਤਰ੍ਹਾਂ ਠੀਕ ਕਰਕੇ ਦੇਣਾ ਕੋਈ ਕੰਪਲੇਂਟ ਨਹੀਂ ਕੀ ਦਿੱਕਤ ਕੀ ਹੋ ਸਕਦੀ ਇਹਦੇ ਵਿੱਚ ਕਿਉਂ ਇਸ ਓਕੇ ਔਰ ਉਹਦੇ ਗੇਅਰ ਵਗੈਰਾ ਵਿੱਚ ਹਾਂਜੀ ਉਹ ਵਾ ਵਾਸ਼ਿੰਗ ਵਗੈਰਾ ਵੀ ਕਰ ਦਿਓ ਧੋ ਸਰਵਿਸ ਵਗੈਰਾ ਕਰਦੇ ਹੋ ਨਾਲ ਓਕੇ ਸਾਰਾ ਕੁਛ ਕਰਵਾ ਦੇਣਾ ਫਿਰ ਤੁਸੀਂ ਨਾ ਪੂਰੀ ਪ੍ਰੋਪਰ ਐਕਚੁਲੀ ਦੋ ਤਿੰਨ ਦਿਨ ਦੇ ਲਈ ਬਾਹਰ ਜਾਣਾ ਹੈ ਪੂਰੀ ਪ੍ਰੋਪਰ ਸਹੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਹਾਂਜੀ ਠੀਕ ਹੈ ਓਕੇ ਧੰਨਵਾਦ